ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵਾਹ ਠੀਕ ਠਾਕ ਕੀ ਕਰਦੀ ਸੀ ਹਾਂ ਤੇ ਮੇਰਾ ਮੁੰਡਾ ਕੱਲ੍ਹ ਘੁੰਮਣ ਗਿਆ ਸੀ ਬਾਹਰ ਅਤੇ ਉਹ ਕਹਿੰਦਾ ਆਪਣੇ ਇੱਥੇ ਸ਼ੂਟਿੰਗ ਹੋ ਰਹੀ ਹੈ ਕਿਸੇ ਫਿਲਮ ਦੀ ਹੋਰ ਕੀ ਚੱਲੀਏ ਆਹੋ ਅਤੇ ਨਾਲ ਹੋਰ ਵੀ ਇੱਕ ਜਣੀਆਂ ਨੂੰ ਪੁੱਛ ਲੈ ਇੱਕ ਦੋ ਜਣੀਆਂ ਨੂੰ ਲਾਗੇ ਚੱਲ ਪੈਂਦੀਆਂ ਵਾਂ ਵਿਹਲੀਆਂ ਹੀ ਆ ਆਹੋ ਤਾਂ ਉਹਨੂੰ ਵੀ ਪੁੱਛ ਲਾ ਚੱਲ ਤੁਰ ਪੈਂਦੀਆਂ ਤਾਂ ਮੈਨੂੰ ਫੋਨ ਕਰਦੀ ਜੇ ਤੁਹਾਡਾ ਪ੍ਰੋਗਰਾਮ ਭੁੱਲ ਨਾ ਜਾਈਂ ਕਿਤੇ ਮੈਨੂੰ ਅੱਛਾ ਚੱਲ ਫਿਰ ਆਪਾਂ ਵੀ ਵੇਖ ਆਵਾਂਗੀਆਂ ਧਰਮਰਾਜ ਨੂੰ ਜਾ ਕੇ ਕਹਿ ਦਾਂਗੀਆਂ ਕਿ ਅਸੀਂ ਵੀ ਸ਼ੂਟਿੰਗ ਵੇਖੀ ਸੀ ਚੱਲ ਹਾਂ ਤਿਆਰ ਹੋ ਕੇ ਤਾਂ ਫਿਰ ਮੈਨੂੰ ਤਿਆਰ ਹੋਣ ਤੋਂ ਪਹਿਲਾਂ ਦੱਸੀਂ ਇਹ ਨਾ ਹੋਵੇ ਤੂੰ ਤਿਆਰ ਹੋ ਕੇ ਮੈਨੂੰ ਫੋਨ ਕਰੇਂ ਚੱਲ ਠੀਕ ਆ ਫਿਰ ਆਹੋ ਹਾਂ ਹਾਂ ਹਾਂ ਹਾਂ ਓਕੇ ਓਕੇ ਸਤਿ ਸ਼੍ਰੀ ਅਕਾਲ